ਪੰਜਾਬੀ ਸਾਡੀ ਮਾਤ ਬੋਲੀ ਹੈ ਸਾਡੀ ਮਾਂ ਬੋਲੀ ਹੈ ਅਤੇ ਹੁਣ ਇਹ ਦਿਨੋ ਦਿਨ ਆ ਜਿਹੜੀ ਇਹ ਘੱਟਦੀ ਜਾ ਰਹੀ ਹੈ ਸਾਡੇ ਪੰਜਾਬ ਦੇ ਵਿੱਚ ਵੀ ਸਰਕਾਰੀ ਸਕੂਲਾਂ ਦੇ ਵਿੱਚ ਵੀ ਪੰਜਾਬੀ ਬਹੁਤ ਹੀ ਜ਼ਿਆਦਾ ਘੱਟ ਚੁੱਕੀ ਹੈ ਸਭ ਕੁਛ ਇੰਗਲਿਸ਼ ਮੀਡੀਅਮ ਹੋ ਚੁੱਕਿਆ ਹੈ ਅਤੇ ਇੰਗਲਿਸ਼ ਮੀਡੀਅਮ ਹੋਣ ਕਰਕੇ ਲੋਕ ਆਪਣੀ ਮਾਂ ਬੋਲੀ ਨੂੰ ਭੁੱਲਦੇ ਜਾ ਰਹੇ ਹੈ ਅਤੇ ਇਸ ਕਰਕੇ ਇੰਗਲਿਸ਼ ਦੇ ਆਉਣ ਨਾਲ ਲੋਕ ਜ਼ਿਆਦਾਤਰ ਇੰਗਲਿਸ਼ ਦੇ ਵੱਲ ਭੱਜ ਰਹੇ ਹੈ ਅਤੇ ਪੰਜਾਬੀ ਨੂੰ ਭੁੱਲਦੇ ਜਾ ਰਹੇ ਹੈ ਅਤੇ ਇਹ ਪੰਜਾਬੀ ਸਰਕਾਰੀ ਸਕੂਲਾਂ ਦੇ ਵਿੱਚ ਪੰਜਾਬੀ ਬਹੁਤ ਹੀ ਜ਼ਿਆਦਾ ਘੱਟ ਪੜ੍ਹਾਈ ਜਾ ਰਹੀ ਹੈ ਅਤੇ ਜਿਸ ਕਰਕੇ ਬੱਚੇ ਆਪਣੀ ਪੰਜਾਬੀ ਮਾਂ ਬੋਲੀ ਤੋਂ ਬਿਲਕੁਲ ਵੀ ਜਾਣੂ ਨਹੀਂ ਹੋ ਰਹੇ ਇਸ ਕਰਕੇ ਪ ਵੱਧ ਤੋਂ ਵੱਧ ਯਤਨ ਕਰਨੇ ਚਾਹੀਦੇ ਐਂ ਵੀ ਤਾਂ ਜੋ ਲੋਕ ਪੰਜਾਬੀ ਪੜ੍ਹ ਸਕਣ ਅਤੇ ਸਰਕਾਰੀ ਸਕੂਲਾਂ ਦੇ ਵਿੱਚ ਵੱਧ ਤੋਂ ਵੱਧ ਪੰਜਾਬੀ ਪੜ੍ਹਾਈ ਜਾ ਸਕੇ ਪੰਜਾਬੀ ਇਸ ਕਰਕੇ ਸਰਕਾਰ ਨੂੰ ਯਤਨ ਕਰਨੇ ਚਾਹੀਦੇ ਹਨ ਕਿ ਵੱਧ ਤੋਂ ਵੱਧ ਪੰਜਾਬੀ ਨੂੰ ਉਤਸ਼ਾਹਿਤ ਕੀਤਾ ਜਾ ਸਕੇ